ਹੈਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਕੀ ਕੰਮ ਸੀ ਅੱਛਾ ਜਿਹੜਾ ਸਾਡਾ ਇਲਾਕਾ ਨਾ ਇਹ ਜਿਹੜਾ ਨਾ ਦੇ ਥੱਲੇ ਪੈਂਦਾ ਬਿਲਕੁਲ ਪੈਰਾਂ 'ਚ ਅਤੇ ਨਾ ਇੱਥੇ ਮੌਸਮ ਦਾ ਕੁਝ ਨਹੀਂ ਹੈ ਇਹ ਬਦਲਦਾ ਰਹਿੰਦਾ ਕਦੇ ਵੀ ਧੁੱਪ ਪੈ ਸਕਦੀ ਹੈ ਕਦੇ ਵੀ ਬਾਰਿਸ਼ ਹੋ ਸਕਦੀ ਹੈ ਕੁਛ ਵੀ ਹੋ ਸਕਦਾ ਅਤੇ ਤੁਸੀਂ ਆਪਣੇ ਹਿਸਾਬ ਨਾਲ ਕੱਪੜੇ ਸਾਰੇ ਰੱਖਿਓ ਆਪਣੇ ਕੋਲ ਵੱਧ ਤੋਂ ਵੱਧ ਅਤੇ ਵੈਸੇ ਤਾਂ ਡਾਕਟਰ ਹੈ ਲਾਗੇ ਪਰ ਇੰਨਾਂ ਤੁਸੀਂ ਬਿਮਾਰ ਹੋਣ ਦਾ ਸੋਚੋ ਨਾ ਵੀ ਇੰਨਾਂ ਕੁਝ ਹੈ ਨਹੀਂ ਹੈ ਜਦ ਤੁਸੀਂ ਇੱਥੇ ਰਹਿਣਾ ਸ਼ੁਰੂ ਕਰੋਗੇ ਤੁਸੀਂ ਨਾਲ ਦੇ ਨਾਲ ਅਡੈਪਟ ਕਰ ਲੋਗੇ ਸਭ ਕੁਝ ਠੀਕ ਹੈ ਠੀਕ ਹੈ ਓਕੇ